ਪੰਜਾਬ ਵਿੱਚ ਕਈ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਪਰ ਜੋ ਕਿ ਮੁੱਖ ਖੇਡਾਂ ਖੇਡੀਆਂ ਜਾਂਦੀਆਂ ਹਨ ਉਹ ਹੈ ਕ੍ਰਿਕੇਟ ਫੁੱਟਬੋਲ ਕਬੱਡੀ ਆਦਿ ਕ੍ਰਿਕੇਟ ਅਸੀਂ ਕਹਿ ਸਕਦੇ ਹਨ ਕਿ ਪੂਰੇ ਭਾਰਤ ਅਤੇ ਪੰਜਾਬ ਦਾ ਮੁੱਖ ਖੇਡ ਹੈ ਕਿਉਂਕਿ ਸਾਰੇ ਹੀ ਸਟੇਡੀਅਮ ਭਰੇ ਰਹਿੰਦੇ ਹਨ ਜਦੋਂ ਵੀ ਕਿਤੇ ਕੋਈ ਕ੍ਰਿਕੇਟ ਮੈਚ ਹੁੰਦਾ ਹੈ ਜੇਕਰ ਉਹ ਭਾਰਤ ਵਿੱਚ ਹੋਵੇ ਜਾਂ ਕਿਤੇ ਵਿਦੇਸ਼ ਹੋਵੇ ਭਾਰਤ ਵਿੱਚ ਇੱਕ ਮੁੱਖ ਲੀਗ ਵੀ ਕੀਤੀ ਜਾਂਦੀ ਹੈ ਜੋ ਕਿ ਆਈ ਪੀ ਐੱਲ ਹੈ ਇਸ ਵਿੱਚ ਸਟੇਡੀਅਮ ਪੂਰਾ ਭਰਿਆ ਰਹਿੰਦਾ ਹੈ ਅਤੇ ਇਹ ਦਿਖਾਉਂਦਾ ਹੈ ਕਿ ਪੰਜਾਬ ਦੇ ਲੋਕ ਕਿਸ ਕਦਰ ਕ੍ਰਿਕੇਟ ਨੂੰ ਪਿਆਰ ਕਰਦੇ ਹਨ ਅਤੇ ਪੰ ਕ੍ਰਿਕੇਟ ਤੋਂ ਬਾਅਦ ਕਬੱਡੀ ਵੀ ਇੱਕ ਮੁੱਖ ਖੇਡ ਹੈ ਕਿਉਂਕਿ ਅਸੀਂ ਆਪਣੇ ਆਲ਼ੇ ਦੁਆਲ਼ੇ ਕਈ ਜਗ੍ਹਾ ਦੇਖਦੇ ਹਨ ਕਿ ਬੱਚੇ ਸੁਬਾ ਅਤੇ ਸ਼ਾਮ ਹਮੇਸ਼ਾ ਹੀ ਕਬੱਡੀ ਖੇਡਦੇ ਹਨ ਅਤੇ ਉਹ ਬਹੁਤ ਖੁਸ਼ ਹੁੰਦੇ ਹਨ ਜਦੋਂ ਉਹ ਇਸ ਖੇਡ ਨੂੰ ਖੇਡ ਰਹੇ ਹੁੰਦੇ ਹਨ ਇਸ ਤੋਂ ਬਾਅਦ ਅਸੀਂ ਕਹਿ ਸਕਦੇ ਹਨ ਕਿ ਟੈਨਿਸ ਵੀ ਇੱਕ ਮੁੱਖ ਖੇਡ ਹੈ ਕਿਉਂਕਿ ਕਈ ਸਾਰੀ ਔਰਤਾਂ ਵੀ ਇਸ ਨੂੰ ਖੇਡਦੀਆਂ ਹਨ ਅਤੇ ਉਹ ਆਪਣੇ ਬੱਚਿਆਂ ਨੂੰ ਵੀ ਅੱਗੇ ਕਹਿੰਦੀਆਂ ਹਨ ਕਿ ਉਹ ਇਸ ਖੇਡ ਨੂੰ ਖੇਡਣ ਅਤੇ ਆਪਣੇ ਦੇਸ਼ ਨੂੰ ਸੰਮਾਨ ਦ ਦੇਵਣ